ਸਭ ਤੋਂ ਦਿਲਚਸਪ ਜਗ੍ਹਾ ਜਿੱਥੇ ਮੈਂ ਗਿਆ ਹੋਇਆ ਵਾਂ ਉਹ ਮਨਾਲੀ ਹੈ ਮਨਾਲੀ ਬਹੁਤ ਹੀ ਵਧੀਆ ਟੂਰਿਸਟ ਪਲੇਸ ਹੈ ਜੋ ਹਿਮਾਚਲ ਵਿੱਚ ਹੈ ਮਨਾਲੀ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਇਹ ਪਹਾੜਾਂ ਵਿੱਚ ਹੈ ਇੱਥੇ ਬਹੁਤ ਹੀ ਖੂਬਸੂਰਤ ਪਹਾੜ ਹਨ ਅਤੇ ਬਹੁਤ ਹੀ ਵਾਦੀਆਂ ਹਨ ਮਨਾਲੀ ਦੇ ਨਾਲ ਨਾਲ ਹੋਰ ਵੀ ਕਾਫੀ ਛੋਟੇ ਛੋਟੇ ਹਿੱਲ ਸਟੇਸ਼ਨ ਹਾਂ ਮੈਂ ਸਾਰੇ ਘੁੰਮਿਆ ਹਾਂ ਇਸ ਦਾ ਅਨੁਭਵ ਬਹੁਤ ਹੀ ਅਨੋਖਾ ਹੈ ਮਨਾਲੀ ਤੋਂ ਕੁਛ ਹੀ ਅੱਗੇ ਰੋਹਤਾਂਗ ਹੈ ਜਿੱਥੇ ਕਿ ਬਰਫ ਵੀ ਦੇਖਣ ਨੂੰ ਮਿਲ ਜਾਂਦੀ ਹੈ ਸਾਨੂੰ ਗਰਮੀਆਂ ਵਿੱਚ ਅਸੀਂ ਰੋਹਤਾਂਗ ਮਨਾਲੀ ਤੋਂ ਰੋਹਤਾਂਗ ਮੋਟਰਸਾਈਕਲ 'ਤੇ ਗਏ ਸਾਂ ਇਸ ਵਿੱਚ ਸਾਨੂੰ ਬਹੁਤ ਮਜ਼ਾ ਆਇਆ ਉਸ ਵਕਤ ਬਹੁਤ ਸਨੋਅ ਵੀ ਪਈ ਹੋਈ ਸੀ ਅਤੇ ਰੈਂਟ ਵੀ ਬਹੁਤ ਜ਼ਿਆਦਾ ਹੋਏ ਪਏ ਸਨ ਪਰ ਫਿਰ ਵੀ ਸਾਨੂੰ ਬਹੁਤ ਮਜ਼ਾ ਆਇਆ ਉਦੋਂ ਟੂਰਿਸਟ ਵੀ ਬਹੁਤ ਜ਼ਿਆਦਾ ਸੀ ਅਤੇ ਹੋਟਲਾਂ ਦੇ ਰੈਂਟ ਵੀ ਕਾਫੀ ਸਨ ਪਰ ਇਹ ਮਨਾਲੀ ਵਿੱਚ ਬਹੁਤ ਹੀ ਟੂਰਿਸਟ ਜਾਂਦਾ ਹੈ ਕਿਉਂਕਿ ਇਹ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਤਾਂ ਲੋਕ ਇੱਥੇ ਜਾਣਾ ਬਹੁਤ ਪਸੰਦ ਕਰਦੇ ਹਨ